ਪੌਦੇ ਉਗਾਉਣ ਲਈ ਮੈਂ ਡਾਕਰ ਮਿੱਟੀ ਵਰਤਦਾ ਹਾਂ ਚੀਕਣੀ ਮਿੱਟੀ ਅਤੇ ਮੈਂ ਰੇਤਲੀ ਮਿੱਟੀ ਨਹੀਂ ਵਰਤਦਾ ਅਤੇ ਉਹਦੇ ਵਿੱਚ ਰੇਤਲੀ ਮਿੱਟੀ ਦੇ ਵਿੱਚ ਜ਼ਿਆਦਾਤਰ ਪਾਣੀ ਲਗਾਉਣ ਦਾ ਰਹਿੰਦਾ ਹੈ ਅਤੇ ਡਾਕਰ ਮਿੱਟੀ ਵਿੱਚ ਬਹੁਤ ਵਧੀਆ ਤਰੀਕੇ ਨਾਲ ਪੌਦਾ ਹੋ ਜਾਂਦਾ ਅਤੇ ਖਾਦ ਮੈਂ ਰੂੜੀ ਦੀ ਖਾਦ ਵਰਤਦਾ ਅਤੇ ਬਹੁਤ ਜ਼ਿਆਦਾ ਵਧੀਆ ਖਾਦ ਉਸ ਨਾਲ ਬਹੁਤ ਵਧੀਆ ਤਰੀਕੇ ਨਾਲ ਪੌਦੇ ਦੀ ਪੈਦਾਵਾਰ ਵੱਧਦੀ ਹੈ